ਹਾਂਜੀ ਹਾਂਜੀ ਹਾਂਜੀ ਹਾਂਜੀ ਤੁਹਾਡਾ ਨਾਮ ਕੀ ਹੈ ਓਕੇ ਜਸ਼ਨ ਹਾਂਜੀ ਮੈਂ ਨਾ ਲਗਭਗ ਦਸ ਸਾਲਾਂ ਤੋਂ ਪੰਜਾਬ 'ਚ ਹੀ ਰਹਿ ਰਹੀ ਹਾਂ ਅਤੇ ਤੁਸੀਂ ਪੰਜਾਬ ਦੇ ਵਿੱਚ ਨਵੇਂ ਕਿੰਨੇ ਕੁ ਟਾਈਮ ਤੋਂ ਆਏ ਓਂਗੇ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਇੱਥੇ ਆਇਆ ਨੂੰ ਓਕੇ ਤੁਸੀਂ ਨਾ ਮਤਲਬ ਪੰਜਾਬ ਦੇ ਵਿੱਚ ਅੱਜ ਜਿਵੇਂ ਹੁਣ ਜਿਹੜੇ ਸ਼ਹੀਦੀ ਦਿਨ ਚੱਲ ਰਹੇ ਨੇ ਫਤਿਹਗੜ੍ਹ ਸਾਹਿਬ ਦੇ ਵਿੱਚ ਗੁਰਦੁਆਰਾ ਸਾਹਿਬ ਬਣਿਆ ਹੋਇਆ ਗਾ ਇੱਥੇ ਪਟਿਆਲੇ ਦੇ ਨੇੜੇ ਹੀ ਹੈਗਾ ਸਰਹਿੰਦ ਫਤਿਹਗੜ੍ਹ ਸਾਹਿਬ ਤੁਸੀਂ ਉੱਥੇ ਘੁੰਮ ਸਕਦੇ ਹੋ ਜਾ ਕੇ ਅੱਜ ਕੱਲ੍ਹ ਸ਼ਹੀਦੀ ਦਿਨ ਚੱਲਦੇ ਆ ਤਾਂ ਉੱਥੇ ਮਤਲਬ ਅੱਜ ਕੱਲ੍ਹ ਬਹੁਤ ਰਸ਼ ਹੈਗਾ ਉੱਥੇ ਗੁਰਦੁਆਰੇ ਬਣੇ ਹੋਏ ਹੈਗੇ ਆ ਠੰਡਾ ਬੁਰਜ ਬਣਿਆ ਹੋਇਆ ਗਾ ਤੁਸੀਂ ਸੁਣਿਆ ਹੀ ਹੋਵੇਗਾ ਵੀ ਜਿਹੜੇ ਮਤਲਬ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਸੀਗੇ ਉਹਨਾਂ ਨੂੰ ਨੀਹਾਂ ਦੇ ਵਿੱਚ ਚਿਣਵਾ ਤਾ ਸੀਗਾ ਤਾਂ ਉਹਨਾਂ ਦੀ ਯਾਦ ਦੇ ਵਿੱਚ ਜਿਹੜਾ ਇਹ ਉੱਥੇ ਸ਼ਹੀਦੀ ਮੇਲਾ ਲੱਗਦਾ ਹੈਗਾ ਤਾਂ ਤੁਸੀਂ ਉੱਥੇ ਘੁੰਮ ਸਕਦੇ ਓਂਗੇ ਜਾਂ ਤੁਸੀਂ ਅੰਮ੍ਰਿਤਸਰ ਸਾਹਿਬ ਜਾ ਸਕਦੇ ਓਂਗੇ ਉੱਥੇ ਗੋਲਡਨ ਟੈਂਪਲ ਬਣਿਆ ਹੋਇਆ ਹੈਗਾ ਉੱਥੇ ਜਾ ਸਕਦੇ ਹੋ ਉੱਥੇ ਦੇਖ ਸਕਦੇ ਓਂਗੇ ਜਲਿਆਂਵਾਲਾ ਬਾਗ ਆ ਉੱਥੇ ਤੁਸੀਂ ਹੈ ਨਾ ਸੁਣਿਆ ਹੀ ਹੋਵੇਗਾ ਵੀ ਉੱਥੇ ਮਤਲਬ ਵਿਸਾਖੀ ਵਾਲੇ ਦਿਨ ਲੋਕਾਂ ਨੂੰ ਮਤਲਬ ਅੰਗਰੇਜ਼ਾਂ ਨੇ ਜਿਹੜਾ ਮਾਰਿਆ ਸੀਗਾ ਤਾਂ ਤੁਸੀਂ ਉਹ ਜਗ੍ਹਾ ਜਾ ਕੇ ਦੇਖ ਸਕਦੇ ਓਂਗੇ ਅਟਾਰੀ ਬੋਡਰ ਹੈਗਾ ਤੁਸੀਂ ਉੱਥੇ ਵੀ ਜਾ ਕੇ ਘੁੰਮ ਸਕਦੇ ਓਂਗੇ ਜਾਂ ਫਿਰ ਮਤਲਬ ਇੱਥੇ ਪਟਿਆਲੇ ਦੇ ਵਿੱਚ ਸ਼ੀਸ਼ ਮਹਿਲ ਹੈਗਾ ਅਨੰਦਪੁਰ ਸਾਹਿਬ ਹੈਗਾ ਤੁਸੀਂ ਉੱਥੇ ਵੀ ਜਾ ਸਕਦੇ ਹੋ ਉੱਥੇ ਵੀ ਕਾਫੀ ਸਾਰੀ ਜਗ੍ਹਾ ਘੁੰਮਣ ਨੂੰ ਨੇ ਮਤਲਬ ਹੋਰ ਵੀ ਬਹੁਤ ਸਾਰੀ ਜਗ੍ਹਾ ਹੈਗੀਆਂ ਨੇ ਘੁੰਮਣ ਨੂੰ ਤੁਸੀਂ ਉਹ ਸਾਰੀਆਂ ਜਗ੍ਹਾ 'ਤੇ ਵੀ ਜਾ ਸਕਦੇ ਓਂਗੇ ਬਾਕੀ ਤੁਸੀਂ ਮਤਲਬ ਮੇਰੇ ਨਾਲ ਕੰਟੈਕਟ ਕਰ ਸਕਦੇ ਓਂਗੇ ਤੁਸੀਂ ਜਦੋਂ ਕਦੇ ਜਾਣਾ ਹੋਇਆ ਘੁੰਮਣ ਵਾਸਤੇ ਜਾਂ ਹੋਰ ਕੋਈ ਜਾਣਕਾਰੀ ਲੈਣੀ ਹੋਈ ਤਾਂ ਤੁਸੀਂ ਮੈਨੂੰ ਕਦੇ ਵੀ ਕਾਲ ਕਰ ਸਕਦੇ ਓਂਗੇ ਕੋਈ ਪ੍ਰੋਬਲਮ ਨਹੀਂ ਹੈਗੀ ਮਤਲਬ ਮੈਂ ਤੁਹਾਡੇ ਨਾਲ ਵੀ ਜਾ ਸਕਦੀ ਹਾਂ ਤੁਹਾਨੂੰ ਹੋਰ ਵੀ ਹੈਲਪ ਕਰ ਸਕਦੀ ਹਾਂ ਤੁਹਾਡੀ ਜਾਣ ਦੇ ਵਿੱਚ ਹਾਂਜੀ ਓਕੇ ਜੀ ਓਕੇ